ਪਿਆਰੇ ਰੋਹਨ ਜਿਵੇਂ ਕਿ ਤੈਨੂੰ ਪਤਾ ਹੀ ਹੈ ਕਿ ਸੰਗੀਤ ਮੈਨੂੰ ਬਹੁਤ ਜ਼ਿਆਦਾ ਪਸੰਦ ਹੈ ਸੰਗੀਤ ਮੇਰੀ ਇੱਕ ਹੋਬੀ ਹੈ ਇਸ ਦੇ ਲਈ ਨਾਲ ਮੈਨੂੰ ਮੇਰੇ ਮਨ ਨੂੰ ਸੰਤੁਸ਼ਟੀ ਮਿਲਦੀ ਹੈ ਮੈਂ ਸੰਗੀਤ ਨੂੰ ਸੁਣਨਾ ਬਹੁਤ ਪਸੰਦ ਕਰਦਾ ਹਾਂ ਅਤੇ ਇਹ ਮਾਨ ਦੀ ਗੱਲ ਹੈ ਕਿ ਸਾਡੇ ਸ਼ਹਿਰ ਦੇ ਵਿੱਚ ਵੀ ਸੰਗੀਤ ਸਮਾਰੋਹ ਹੋਣ ਜਾ ਰਿਹਾ ਹੈ ਮੈਂ ਇਸ ਦੇ ਲਈ ਟਿਕਟਾਂ ਬੁੱਕ ਕਰਨਾ ਚਾਹੁੰਦਾ ਹਾਂ ਪਰ ਮੈਂ ਪ੍ਰਚਾਰ ਦੀ ਪੇਸ਼ਕਸ਼ ਦੀ ਉਮੀਦ ਵਿੱਚ ਅਜੇ ਤੱਕ ਅਜਿਹਾ ਨਹੀਂ ਕੀਤਾ ਮੈਂ ਇਹੀ ਸੋਚ ਰਿਹਾ ਹਾਂ ਕਿ ਹੋ ਸਕਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਛੋਟ ਇਹਨਾਂ ਟਿਕਟਾਂ ਦੀ ਬੁਕਿੰਗ ਦੇ ਉੱਤੇ ਹੋਵੇ ਅਤੇ ਤੁਹਾਨੂੰ ਪਤਾ ਹੀ ਹੈ ਕਿ ਮੈਂ ਮੈਨੂੰ ਇਸ ਬਾਰੇ ਹਾਲੇ ਪੂਰੀ ਤਰ੍ਹਾਂ ਜਾਣਕਾਰੀ ਨਹੀਂ ਹੈ ਇਹ ਸੰਗੀਤ ਦਾ ਪ੍ਰੋਗਰਾਮ ਕਿੰਨੇ ਵਜੇ ਸ਼ੁਰੂ ਹੋਵੇਗਾ ਇਸ ਪ੍ਰੋਗਰਾਮ ਦੇ ਵਿੱਚ ਕੌਣ ਕੌਣ ਹਿੱਸਾ ਲਵੇਗਾ ਇਸ ਪ੍ਰੋਗਰਾਮ ਨੂੰ ਕਿੱਥੇ ਆਯੋਜਿਤ ਕੀਤਾ ਜਾਵੇਗਾ ਇਹ ਸਾਰੀਆਂ ਗੱਲਾਂ ਜਾਣਨਾ ਬਹੁਤ ਜ਼ਰੂਰੀ ਹੈ ਜੇਕਰ ਤੈਨੂੰ ਇਹਨਾਂ ਬਾਰੇ ਪਤਾ ਲੱਗਦਾ ਹੈ ਕਿ ਇਹ ਕਿਸ ਸਮੇਂ ਹੋਵੇਗਾ ਕਿੰਨੇ ਵਜੇ ਤੋਂ ਲੈ ਕੇ ਕਿੰਨੇ ਵਜੇ ਤੱਕ ਆਵੇਗਾ ਅਤੇ ਕਿਹੜੇ ਕਿਹੜੇ ਕਲਾਕਾਰ ਇਸ ਦੇ ਵਿੱਚ ਹਿੱਸਾ ਲੈ ਰਹੇ ਹਨ ਮੈਨੂੰ ਇਸ ਬਾਰੇ ਸਾਰੀ ਜਾਣਕਾਰੀ ਕਿਰਪਾ ਕਰਕੇ ਦਿਓ ਕਿਉਂਕਿ ਸੰਗੀਤ ਨੂੰ ਸੁਣਨਾ ਮੇਰੇ ਲਈ ਬਹੁਤ ਮਾਣ ਦੀ ਗੱਲ ਹੈ ਇਸ ਦੇ ਨਾਲ ਹੀ ਇੱਕ ਬੇਨਤੀ ਹੋਰ ਵੀ ਹੈ ਕਿ ਜੇਕਰ ਕਿਸੇ ਵੀ ਤਰ੍ਹਾਂ ਦੀ ਕੋਈ ਛੋਟ ਟਿਕਟਾਂ ਦੀ ਬੁਕਿੰਗ ਦੇ ਉੱਤੇ ਹੁੰਦੀ ਹੈ ਤਾਂ ਮੈਨੂੰ ਇਸ ਬਾਰੇ ਵੀ ਦੱਸਿਓ ਤਾਂ ਕਿ ਮੈਂ ਆਪਣੇ ਨਾਲ ਕਿਸੇ ਹੋਰ ਦੇ ਆਉਣ ਜਾਣ ਦਾ ਵੀ ਪ੍ਰਬੰਧ ਕਰ ਸਕਾਂ ਉਸ ਦੇ ਮਨ ਨੂੰ ਵੀ ਇਸ ਦੇ ਨਾਲ ਸ਼ਾਂਤੀ ਮਿਲੇ ਮੈਂ ਅਤੇ ਮੇਰਾ ਪਰਿਵਾਰ ਸੰਗੀਤ ਸੁਣ ਕੇ ਬਹੁਤ ਹੀ ਖੁਸ਼ੀ ਮਹਿਸੂਸ ਕਰਾਂਗੇ ਸਾਡੇ ਮਨ ਨੂੰ ਸੰਤੁਸ਼ਟੀ ਮਿਲੇਗੀ ਅਤੇ ਕਿਰਪਾ ਕਰਕੇ ਇਹੀ ਮੇਰੀ ਬੇਨਤੀ ਹੈ ਕਿ ਮੈਨੂੰ ਪਲੀਜ਼ ਦੱਸਿਓ ਕਿ ਇਹ ਪ੍ਰੋਗਰਾਮ ਕਦੋਂ ਕਿੱਥੇ ਅਤੇ ਕਿੰਨੇ ਵਜੇ ਹੋਣ ਜਾ ਰਿਹਾ ਹੈ ਅਤੇ ਇਸ ਦੀਆਂ ਟਿਕਟਾਂ ਦੀ ਬੁਕਿੰਗ ਦੇ ਉੱਤੇ ਕਿੰਨੀ ਕਿੰਨੀ ਛੋਟ ਕੀਤੀ ਜਾਵੇਗੀ